ਮੈਂ ਦੀਕਸ਼ਾ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਗਲਪ ਜਾਂ ਗੈਰ ਗਲਪ ਲਿਖਣਾ ਪਸੰਦ ਹੈ ਅਤੇ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਮੈਂ ਕਿਸੇ ਕਹਾਣੀ ਬਾਰੇ ਪੜ੍ਹਾਂ ਅਤੇ ਉਸ ਤੋਂ ਕੁਝ ਸਿੱਖਾਂ ਅਤੇ ਉਸ ਵਿੱਚ ਅਸੀਂ ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਕਿਵੇਂ ਉਤਾਰ ਸਕਦੇ ਹਾਂ ਇਹ ਸਭ ਮੈਨੂੰ ਪੜ੍ਹਨਾ ਚੰਗਾ ਲਗਦਾ ਹੈ ਅਤੇ ਉਸ ਕਹਾਣੀ ਤੋਂ ਜੋ ਸਿੱਖਿਆ ਮਿਲਦੀ ਹੈ ਉਹਨੂੰ ਆਪਣੇ ਜੀਵਨ ਵਿੱਚ ਉਤਾਰਨਾ ਵੀ ਚੰਗਾ ਲੱਗਦਾ ਹੈ ਜਿਸ ਨਾਲ ਸਾਡੇ ਜੀਵਨ ਵਿੱਚ ਇੱਕ ਨਵੀਂ ਊਰਜਾ ਜਿਹੜੀ ਹੈ ਉਹ ਉਤਪੰਨ ਹੁੰਦੀ ਹੈ ਅਤੇ ਮੇਰੇ ਮਨ ਪਸੰਦ ਜੋ ਪੰਜਾਬੀ ਦੇ ਲੇਖਕ ਹਨ ਉਹ ਹਨ ਸ਼ਿਵ ਕੁਮਾਰ ਬਟਾਲਵੀ ਜੀ ਉਹਨਾਂ ਨੇ ਬਹੁਤ ਸਾਰੀਆਂ ਗਲਪ ਜਾਂ ਗੈਰ ਗਲਪ ਜਿਹੜੀਆ ਕਹਾਣੀਆਂ ਹਨ ਉਹ ਲਿਖੀਆਂ ਹਨ ਉਹਨਾਂ ਦੀ ਜਿਹੜੀਆਂ ਕਹਾਣੀਆਂ ਹਨ ਉਹ ਜ਼ਿਆਦਾਤਰ ਜਿਹੜੀਆਂ ਹੁੰਦੀਆਂ ਹਨ ਉਹ ਪਿਆਰ ਅਤੇ ਜਾਂ ਫਿਰ ਸਾਨੂੰ ਰਿਸ਼ਤੇ ਕਿਵੇਂ ਨਿਭਾਉਣੇ ਚਾਹੀਦੇ ਹਨ ਇਹਨਾਂ 'ਤੇ ਉਹ ਜ਼ਿਆਦਾ ਕਹਾਣੀਆਂ ਲਿਖਦੇ ਹਨ ਇਸ ਤੋਂ ਇਲਾਵਾ ਉਹ ਨੇਚਰ ਅਤੇ ਜਿਹੜਾ ਸਾਡਾ ਕੁਦਰਤੀ ਸੁੰਦਰਤਾ ਹੈ ਉਹਦੇ ਬਾਰੇ ਵੀ ਉਹਨਾਂ ਦੀ ਬਹੁਤ ਸਾਰੀਆਂ ਜਿਹੜੀਆਂ ਹਨ ਕਹਾਣੀਆਂ ਹਨ ਤਾਂ ਮੈਨੂੰ ਉਹਨਾਂ ਦੀ ਕਹਾਣੀਆਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜੇ ਆਪਣੇ ਰਿਸ਼ਤੇ ਹੈ ਉਹ ਪਿਆਰ ਨਾਲ ਕਿਵੇਂ ਅਸੀਂ ਨਿਭਾਅ ਸਕਦੇ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਜਿਹੜੇ ਹੈ ਉਹ ਖਤਮ ਹੁੰਦੇ ਜਾ ਰਹੇ ਹਨ ਧੰਨਵਾਦ